ਮੇਰੇ ਇਲਾਕੇ ਵਿੱਚ ਬਹੁਤ ਪ੍ਰਕਾਰ ਦੇ ਖੇਡ ਕੇਂਦਰ ਹਨ ਗੱਲ ਕਰੀ ਜਾਵੇ ਨਹਿਰੂ ਸਟੇਡੀਅਮ ਦੀ ਜਿੱਥੇ ਕਿ ਅਨੇਕ ਪ੍ਰਕਾਰ ਦੀਆਂ ਖੇਡਾਂ ਅਤੇ ਉਸ ਨੂੰ ਸਿਖਾਉਣ ਵਾਸਤੇ ਕੌਚ ਵੀ ਉਪਲਬਧ ਹਨ ਜਿਵੇਂ ਕਿ ਫੁੱਟਬਾਲ ਹੋ ਗਈ ਵਾਲੀਵਾਲ ਹੋ ਗਈ ਬਾਸਕਟਬਾਲ ਹੋ ਗਈ ਅਤੇ ਉੱਥੇ ਖੇਡ ਕੇਂਦਰਾਂ ਵਿੱਚ ਬਹੁਤ ਤਰ੍ਹਾਂ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਦੀਆਂ ਹਨ ਜਿਵੇਂ ਕਿ ਮੁਫ਼ਤ ਕਿੱਟਾਂ ਅਤੇ ਮੁਫ਼ਤ ਖਾਣਾ ਵੀ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਉੱਥੇ ਆ ਕੇ ਪ੍ਰੈਕਟਿਸ ਕਰਨ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਸਕਣ ਜਿਸ ਸਕੂਲ ਵਿੱਚ ਮੈਂ ਪੜ੍ਹਿਆਂ ਹਾਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਉੱਥੇ ਵੀ ਐਥਲੀਟਾਂ ਨੂੰ ਬਹੁਤ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆ ਹਨ ਅਤੇ ਨਾਲ ਦੇ ਨਾਲ ਹੀ ਉਨ੍ਹਾਂ ਨੂੰ ਹੋਸਟਲ ਵੀ ਮੁਹੱਈਆਂ ਕਰਵਾਇਆ ਜਾਂਦਾ ਹੈ ਤਾਂ ਜੋ ਸਵੇਰੇ ਸ਼ਾਮ ਬੱਚੇ ਆਪਣੇ ਆਪ ਨੂੰ ਉਨ੍ਹਾਂ ਗੇਮਾਂ ਵਿੱਚ ਭਾਗ ਲੈ ਸਕਣ ਅਤੇ ਰਿਹਰਸਲ ਕਰ ਸਕਣ ਤਾਂ ਜੋ ਆਪਣੇ ਸਕੂਲ ਦਾ ਨਾਂ ਉੱਚ ਪੱਧਰ 'ਤੇ ਪ੍ਰਸਿੱਧ ਕਰ ਸਕਣ ਅਤੇ ਆਪਣੇ ਆਪ ਦਾ ਕਰੀਅਰ ਵੀ ਉਨ੍ਹਾਂ ਖੇਡਾਂ ਵਿੱਚ ਬਣਾ ਸਕੇ ਅਤੇ ਆਪਣੇ ਸਕੂਲ ਦਾ ਨਾਂ ਅਤੇ ਆਪਣੇ ਖੇਤਰ ਦਾ ਨਾਂ ਉੱਚ ਪੱਧਰ 'ਤੇ ਪ੍ਰਸਿੱਧ ਕਰੇ ਅਤੇ ਆਪਣੀ ਇੰਡੀਆ ਲੈਵਲ ਦੀ ਟੀਮ ਵਿੱਚ ਜਾ ਕੇ ਬਹੁਤ ਹੀ ਨਾਂ ਆਪਣੇ ਸਕੂਲ ਦਾ ਅਤੇ ਮਾਂ ਪਿਉ ਦਾ ਪ੍ਰਸਿੱਧ ਕਰਨ